ਵੈਸੇ ਦੇਖਿਆ ਜਾਵੇ ਤਾਂ ਮੈਂ ਅੱਜ ਤੱਕ ਕਾਫ਼ੀ ਤਰੀਕੇ ਦੀਆਂ ਪੰਜਾਬੀ ਅਤੇ ਵੈਸਟਰਨ ਡਰੈਸਿਜ ਬਣਾਈਆਂ ਹਨ ਪਰ ਅੱਜ ਤੱਕ ਜਿਹੜੀ ਮੈਂ ਸਭ ਤੋਂ ਔਖੀ ਡਰੈਸ ਸੀਤੀ ਹੈ ਉਹ ਹੈ ਇੱਕ ਲਾਈਨਿੰਗ ਵਾਲਾ ਸੂਟ ਜਦੋਂ ਵੀ ਅਸੀਂ ਕੋਈ ਲਾਈਨਿੰਗ ਵਾਲਾ ਸੂਟ ਸੀਨੇ ਹਾਂ ਤਾਂ ਉਸਦੀ ਜਿਹੜੀ ਸਲਵਾਰ ਹੈ ਉਸਨੂੰ ਸੀਣ ਵਿੱਚ ਬੜੀ ਔਖਿਆਈ ਆਉਂਦੀ ਹੈ ਕਿਉਂਕਿ ਉਹਦੀਆਂ ਜਿਹੜੀਆਂ ਚੋਣਾਂ ਵਾ ਉਹ ਜਲਦੀ ਸੈਟ ਨਹੀਂ ਹੁੰਦੀਆਂ ਅਤੇ ਸਲਵਾਰ ਕਾਫ਼ੀ ਹੈਵੀ ਹੋ ਜਾਂਦੀ ਹੈ ਅਤੇ ਸਭ ਤੋਂ ਸਿੰਪਲ ਸੂਟ ਹੈਗਾ ਹੈ ਇੱਕ ਕੋਟਨ ਦਾ ਸੂਟ ਸੀਣਾ ਉਹ ਸਟਿੱਚ ਕਰਨਾ ਕਾਫ਼ੀ ਸੌਖਾ ਹੁੰਦਾ ਕਿਉਂਕਿ ਉਹਦੇ ਥੱਲੇ ਲਾਈਨਿੰਗ ਨਹੀਂ ਲੱਗਦੀ ਅਤੇ ਸਿੰਪਲ ਸੂਟ ਸੀਣ ਵਿੱਚ ਸਮਾਂ ਵੀ ਘੱਟ ਲੱਗਦਾ ਅਤੇ ਮੇਰਾ ਜਿਹੜਾ ਅੱਜ ਤੱਕ ਦਾ ਸਭ ਤੋਂ ਔਖਾ ਪਹਿਰਾਵਾ ਰਿਹਾ ਹੈ ਉਹ ਇੱਕ ਗਾਊਨ ਸੀ ਜੋ ਕਿ ਮੈਂ ਇੱਕ ਪਾਰਟੀ 'ਤੇ ਪਾ ਕੇ ਜਾਣਾ ਸੀ ਅਤੇ ਜਿਸ ਨੂੰ ਸੀਣ 'ਤੇ ਮੈਂ ਦੋ ਤਿੰਨ ਦਿਨ ਦਾ ਸਮਾਂ ਲਗਾਇਆ ਅਤੇ ਉਹ ਜਦੋਂ ਗਾਉਨ ਪਾਇਆ ਤਾਂ ਉਹ ਤਾਂ ਪਾਰਟੀ 'ਚ ਕਾਫ਼ੀ ਅਨਕੰਫਟੇਬਲ ਫੀਲ ਕੀਤਾ ਕਿਉਂਕਿ ਉਹਦੇ ਥੱਲੇ ਜਿਹੜਾ ਗਾਉਨ ਦਾ ਮਟੀਰੀਅਲ ਹੁੰਦਾ ਹੈ ਉਹ ਕਾਫ਼ੀ ਚੁੱਭਦਾ ਰਿਹਾ ਉਹ ਪਾਉਣ ਵਿੱਚ ਬਿਲਕੁਲ ਵੀ ਆਰਾਮਦਾਇਕ ਨਹੀਂ ਹੁੰਦਾ